ਸਥਾਨਕ ਇੰਡੋਰ ਗੇਮਾਂ ਉਹ ਹਨ ਜਿਹੜੀਆਂ ਆਪਾਂ ਘਰ ਵਿੱਚ ਹੀ ਬੈਠ ਕੇ ਆਪਣੇ ਆਸ ਪੜੋਸ ਨਾਲ ਜਾਂ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਰਿਵਾਰਕ ਮੈਬਰਾਂ ਨਾਲ ਖੇਡ ਸਕਦੇ ਹਾਂ ਇਹ ਇੱਕ ਬੰਦ ਕਮਰੇ ਵਿੱਚ ਵੀ ਖੇਡੀਆਂ ਜਾ ਸਕਦੀਆਂ ਹਨ ਜਿਵੇਂ ਕਿ ਲੂਡੋ ਕੈਰਮ ਸੱਪ ਸੀੜੀ ਸ਼ਤਰੰਜ ਮਾਰਬਲ ਕੋਈ ਵੀ ਸਥਾਨਕ ਗੇਮ ਹੋਰ ਵੀ ਇਸ ਪ੍ਰਕਾਰ ਕਈ ਤਰ੍ਹਾਂ ਦੀਆਂ ਗੇਮਾਂ ਹਨ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ 'ਤੇ ਫੋਨ ਦੇ ਉੱਤੇ ਵੀ ਕਾਫੀ ਪ੍ਰਚੱਲਿਤ ਹਨ ਆਪਾਂ ਫੋਨ 'ਤੇ ਅੋਨਲਾਈਨ ਵੀ ਇਸ ਜਿਹੜੀਆਂ ਸਥਾਨਕ ਇੰਡੋਰ ਖੇਡਾਂ ਆਪਣੇ ਸੱਜਣਾਂ ਮਿੱਤਰਾਂ ਨਾਲ ਜਾਂ ਕਿਸੇ ਵੀ ਅੋਨਲਾਈਨ ਵਿਅਕਤੀ ਦੇ ਨਾਲ ਖੇਡ ਸਕਦੇ ਹਾਂ ਅਸੀਂ ਲੋਕਡਾਊਨ ਵਿੱਚ ਲੂਡੋ ਅਤੇ ਕੈਰਮ ਦੋ ਗੇਮਾਂ ਅਸੀਂ ਬਹੁਤ ਜ਼ਿਆਦੀਆਂ ਖੇਡੀਆਂ ਅਤੇ ਬੜਾ ਹੀ ਆਨੰਦ ਪ੍ਰਾਪਤ ਕੀਤਾ ਇਹ ਬੱਚਿਆਂ ਅਤੇ ਜਵਾਨਾਂ ਵਿੱਚ ਕਾਫੀ ਹਰ ਵਰਗ ਦੇ ਇਨਸਾਨ ਇਸ ਗੇਮ ਨੂੰ ਖੇਡ ਸਕਦੇ ਹਨ